ਮੈਨੂੰ ਬਸੰਤ ਰੁੱਤ ਬਹੁਤ ਪਸੰਦ ਹੈ ਅਤੇ ਮੈਂ ਉਹਦੇ ਵਿੱਚ ਘੁੰਮਣਾ ਪਸੰਦ ਕਰਦਾ ਹਾਂ ਕਿਉਂਕਿ ਉਸ ਰੁੱਤ ਦੇ ਵਿੱਚ ਸਰਦੀ ਅਤੇ ਗਰਮੀ ਦੋਨਾਂ ਰੁੱਤਾਂ ਦਾ ਅਹਿਸਾਸ ਹੁੰਦਾ ਹੈ ਜਿਹਦੇ ਕਰਕੇ ਕਿ ਮੈਂ ਜੇ ਕਿਤੇ ਘੁੰਮਣ ਜਾਣਾ ਵੀ ਹੋਵੇ ਤਾਂ ਨਾ ਹੀ ਮੈਨੂੰ ਜ਼ਿਆਦਾ ਠੰਡ ਲੱਗਦੀ ਹੈ ਅਤੇ ਨਾ ਹੀ ਮੈਨੂੰ ਜ਼ਿਆਦਾ ਗਰਮੀ ਲੱਗਦੀ ਹੈ ਅਤੇ ਜਿਹਦੇ ਕਰਕੇ ਕਿ ਅਸੀਂ ਆਪਣਾ ਘੁੰਮਣ ਵੱਲ ਹੋਰ ਧਿਆਨ ਦੇ ਸਕਦੇ ਹਾਂ ਅਤੇ ਫਿਰ ਉਹਦੇ ਬਾਅਦ ਕਿਤੇ ਕਿਤੇ ਇੱਦਾਂ ਹੁੰਦਾ ਕਿ ਕਦੀ ਕਦਾਰ ਇੱਦਾਂ ਹੁੰਦਾ ਜੇ ਹੁਣ ਜੇ ਗਰਮੀ ਦਾ ਦੇਖਿਆ ਜਾਵੇ ਤਾਂ ਗਰਮੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜ਼ਿਆਦਾ ਹੀ ਗਰਮੀ ਹੋ ਜਾਂਦੀ ਜਿੱਥੇ ਲੋਕਾਂ ਦਾ ਏ ਸੀ ਦੇ ਤੋਂ ਕਮਰੇ 'ਚੋਂ ਬਾਹਰ ਆਉਣ ਦਾ ਜੀਅ ਨਹੀਂ ਕਰਦਾ ਠੰਡ ਦੇ ਵਿੱਚ ਰਜਾਈ ਤੋਂ ਬਾਹਰ ਆਉਣ ਦਾ ਜੀ ਨਹੀਂ ਕਰਦਾ ਅਤੇ ਇਸ ਲਈ ਮੈਨੂੰ ਫਰਵਰ ਸਰਿੰਗ ਸੀਜ਼ਨ ਜ਼ਿਆਦਾ ਵਧੀਆ ਲੱਗਦਾ ਹੈ